ਹੈਲੋ ਹਾਂਜੀ ਤੁਸੀਂ ਬਰਤਨ ਸਟੋਰ ਤੋਂ ਬੋਲਦੇ ਹੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਣੇ ਕੋਲ ਕਿਹੜੇ ਕਿਹੜੇ ਬਰਤਨ ਆ ਦੋਵੇਂ ਜੱਗ ਚਾਹੀਦੇ ਹੈ ਜੀ ਦੋਵੇਂ ਬਾਰੇ ਦੱਸ ਦਿਓ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਇਹਨਾਂ ਦੇ ਰੇਟ ਜੀ ਹਾਂਜੀ ਹਾਂਜੀ ਠੀਕ ਹੈ ਜੀ ਅਤੇ ਛੋਟੇ ਭਾਂਡਿਆਂ ਦਾ ਜੀ ਜਿਹੜੇ ਛੋਟੇ ਬਰਤਨ ਆ ਜਾਂਦੇ ਉਹਨਾਂ 'ਚੋਂ ਜੀ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਠੀਕ ਹੈ ਜੀ ਜਿਵੇਂ ਜੱਗ ਬਾਲਟੀਆਂ ਹੋ ਗਈਆਂ ਵੱਡੀਆਂ ਕੜਛੀਆਂ ਛੋਟੀਆਂ ਕੜਛੀਆਂ ਐਂ ਸਾਰਾ ਕੁਛ ਹੈਗਾ ਜੀ

ਠੀਕ ਹੈ ਜੀ ਸਾਨੂੰ ਜੀ ਅਸੀਂ ਕੋਈ ਨਹੀਂ ਜੀ ਸਾਡੇ ਕੋਲ ਤੁਹਾਡਾ ਐਡਰੈਸ ਵੀ ਆ ਅਤੇ ਨੰਬਰ ਵੀ ਹੈਗਾ ਜੀ ਅਸੀਂ ਇੱਕ ਵਾਰ ਆ ਕੇ ਦੇਖ ਜਾਂਗੇ ਜੀ ਅਤੇ ਨਾਲ ਤੁਸੀਂ ਸਾਨੂੰ ਰੇਟ ਦਾ ਵੀ ਮਾੜਾ ਜਿਹਾ ਦੱਸ ਜਾਂਦੇ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੀ ਹਾਂਜੀ ਹਾਂਜੀ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਅਤੇ ਹੋਰ ਜੀ ਤੁਹਾਡੇ ਕੋਲੇ ਵੱਡੀਆਂ ਕੜਾਹੀਆਂ ਸੋ ਇਉਂ ਦੇਗੇ ਦੁਗੇ ਸਾਰਾ ਕੁਛ ਹੈਗਾ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹਾਂਜੀ ਹਾਂ ਹਾਂਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ